ਹੈਲੋ ਹਾਂਜੀ ਤੁਸੀਂ ਐਮਾਜੋਨ ਦੇ ਦਫਤਰ ਵਿੱਚੋਂ ਬੋਲ ਰਹੇ ਹੋ ਅਤੇ ਮੇਰੇ ਦੁਆਰਾ ਤਹਾਤੋਂ ਇੱਕ ਸਾੜੀ ਮੰਗਾਈ ਗਈ ਸੀ ਸਿਲਕ ਦੀ ਪੀਲੇ ਰੰਗ ਦੀ ਅਤੇ ਉਹ ਬਹੁਤ ਹੀ ਸੁੰਦਰ ਸੀ ਬਹੁਤ ਸੋਹਣੀ ਆ ਪਰ ਜਦੋਂ ਅਸੀਂ ਉਸ ਦਾ ਡੱਬਾ ਖੋਲ੍ਹਿਆ ਤਾਂ ਉਹ ਅਸੀਂ ਜਦੋਂ ਚੰਗੀ ਤਰ੍ਹਾਂ ਚੈੱਕ ਕੀਤੀ ਤਾਂ ਉਸ ਵਿੱਚ ਇੱਕ ਕੱਟ ਲੱਗਿਆ ਹੋਇਆ ਸੀ ਉਹ ਕੱਟ ਇਸ ਤਰ੍ਹਾਂ ਵਿਚਾਲੇ ਆ ਰਿਹਾ ਹੈਗਾ ਵੀ ਉਹ ਪਹਿਨਣ ਦੇ ਵਿੱਚ ਵੀ ਦਿੱਕਤ ਆਵੇਗੀ ਅਤੇ ਇਹ ਅਸੀਂ ਬਹੁਤ ਹੀ ਕੀਮਤੀ ਸਾੜੀ ਮੰਗਵਾਈ ਹੈ ਜਿਸ ਦਾ ਮੁੱਲ ਪੰਦਰਾਂ ਸੌ ਰੁਪਏ ਸੀ ਪਰ ਇਸ ਇਹ ਸਾਨੂੰ ਸੁੰਦਰ ਵੀ ਬਹੁਤ ਲੱਗੀ ਹੁਣ ਅਸੀਂ ਇਹ ਵਾਪਸ ਕਰਨਾ ਚਾਹੁੰਦੇ ਹਾਂ ਇਸ ਦਾ ਵਾਪਸੀ ਦਾ ਸਾਨੂੰ ਪ੍ਰੋਸੈਸ ਦੱਸਿਆ ਜਾਵੇ ਜੀ ਵਾਪਸੀ ਕਰਨ 'ਤੇ ਸਾਨੂੰ ਕੀ ਚਾਰਜ ਲੱਗਣਗੇ ਜਾਂ ਕਿਸ ਤਰ੍ਹਾਂ ਇਹ ਵਾਪਸ ਹੋਵੇਗੀ ਅਤੇ ਇਸ ਨੂੰ ਵਾਪਸ ਸਾਨੂੰ ਚੇਂਜ ਕਰਕੇ ਦੋਵੋਗੇ ਤਾਂ ਇਹ ਕਿੰਨੇ ਸਮੇਂ ਵਿੱਚ ਸਾਡੇ ਕੋਲੇ ਆਵੇਗੀ ਇਸ ਕਰਕੇ ਆਪ ਜੀ ਨੂੰ ਧਿਆਨ ਦਵਾਇਆ ਜਾ ਰਿਹਾ ਹੈ ਕਿ ਇਹ ਸਾਡੇ ਘਰ ਫੰਕਸ਼ਨ ਹੈ ਜਿਸ ਦੀ ਸਾਨੂੰ ਬਹੁਤ ਜ਼ਰੂਰਤ ਹੈ ਇਹ ਸਾੜੀ ਜੋ ਆਪ ਵੱਲੋਂ ਭੇਜੀ ਗਈ ਸੀ ਬਹੁਤ ਸੁੰਦਰ ਸੀ ਪਰ ਸਾਡਾ ਫੰਕਸ਼ਨ ਨੇੜੇ ਹੋਣ ਕਰਕੇ ਸਾਨੂੰ ਇਸ ਦੀ ਜਲਦੀ ਲੋੜ ਹੈ ਕਿਰਪਾ ਕਰਕੇ ਇਹ ਜਿਹੜੀ ਸਾੜੀ ਆ ਸਾਨੂੰ ਚੇਂਜ ਕਰਕੇ ਦਿੱਤੀ ਜਾਵੇ ਜਲਦੀ ਤੋਂ ਜਲਦੀ ਤੁਸੀਂ ਇਹ ਸਾੜੀ ਕਦ ਵਾਪਸ ਕਰ ਰਹੇ ਹੋ ਧੰਨਵਾਦ ਜੀ